ਸਰਦਾਰ ਜਸਵੰਤ ਸਿੰਘ ਸਰਦਾਰਨੀ ਜਸਵੀਰ ਕੌਰ ਸ੍ਰੀ ਮਾਨ ਭੀਮ ਸੈਨ ਕੱਕੜ ਸਰਦਾਰ ਹਰਵਿੰਦਰ ਸਿੰਘ ਔਰ ਸ਼੍ਰੀ ਮਾਨ ਨਰੇਸ਼ ਕੁਮਾਰ ਗੋਤਮ